ਤੁਸੀਂ ਆਪਣਾ ਸਰੀਰ ਬਹੁਤ ਵਧੀਆ ਬਣਾਇਆ ਏ ਇਹ ਮਤਲਬ ਤੁਸੀ ਜਿੰਮ ਤੋਂ ਜਿੰਮ ਲਾਈ ਜਿੰਮ ਲਾਉਂਦੇ ਰਹੇ ਆ ਕਈ ਸਾਲ ਤੋਂ ਜਾਂ ਕੋਈ ਮਤਲਬ ਤੁਸੀਂ ਡੱਬਾ ਡੁਬਾ ਖਾਧਾ ਏ ਜਾਂ ਮਤਲਬ ਤੁਸੀਂ ਇਹਤੋਂ ਅਲੱਗ ਘਰਾਂ ਕੋਈ ਤਿਆਰੀ ਕਰਦੇ ਅਤੇ ਜੀ ਕੋਈ ਮਤਲਬ ਘਰਾਂ ਤਿਆਰੀ ਕਰਕੇ ਤੁਸੀਂ ਸਰੀਰ ਬਣਾ ਲਿਆ ਆਪਣੇ ਆਪ ਏ